ਮੈ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਕੁਝ ਦਿਨ ਪਹਿਲਾਂ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ ਕਿ ਅੱਜ ਕੱਲ੍ਹ ਅਸੀਂ ਹਰ ਚੀਜ਼ ਔਨਲਾਈਨ ਹੀ ਮੰਗਵਾ ਸਕਦੇ ਹਾਂ ਜੋ ਸਾਡੇ ਘਰ ਤੱਕ ਡਿਲੀਵਰ ਕੀਤੀ ਜਾਂਦੀ ਹੈ ਪਰ ਰਸਤੇ ਵਿੱਚ ਜਾਂਦੇ ਜਾਂਦੇ ਸਾਨੂੰ ਬਹੁਤ ਦੁੱਖ ਭੁੱਖ ਲੱਗ ਗਈ ਉੱਥੇ ਮੈਨੂੰ ਇੱਕ ਖਾਣ ਪੀਣ ਦੀਆਂ ਦੁਕਾਨਾਂ ਮਿਲੀਆਂ ਜਿੱਥੇ ਅਸੀਂ ਜਿੱਥੇ ਅਸੀਂ ਖਾਣ ਪੀਣ ਦੀ ਦੁਕਾਨਾਂ ਮਿਲੀਆਂ ਜਿੱਥੇ ਅਸੀਂ ਦੋਵਾਂ ਖਾਣਾ ਖਾ ਖਾਣਾ ਖਾ ਰਹੇ ਸੀ ਤਾਂ ਉਸਨੇ ਮੈਨੂੰ ਦੱਸਿਆ ਕਿ ਅੱਜ ਕੱਲ੍ਹ ਤਾਂ ਅਸੀਂ ਘਰ ਬੈਠੇ ਹੀ ਆਨਲਾਈਨ ਖਾਣਾ ਖਾਣ ਵਾਲੀਆਂ ਚੀਜ਼ਾਂ ਮੰਗਵਾ ਸਕਦੇ ਹਾਂ ਸਾਡੇ ਘਰ ਡਿਲੀਵਰ ਕੀਤੀਆਂ ਜਾਂਦੀਆਂ ਹਨ ਅੱਜ ਇੱਕ ਇੱਕ ਘੰਟਾ ਪਹਿਲਾਂ ਮੈਂ ਸੋਚਿਆ ਕਿ ਅੱਜ ਰਵੀਵਾਰ ਵਾਲੇ ਦਿਨ ਕੁਝ ਖਾਣ ਵਾਸਤੇ ਸਪੈਸ਼ਲ ਆਨਲਾਈਨ ਮੰਗਵਾਵਾਂ ਜਦੋਂ ਮੈਂ ਤੁਹਾਨੂੰ ਤੁਹਾਡੀ ਵੈਬਸਾਈਟ 'ਤੇ ਆਨਲਾਈਨ ਮੰਗਵਾਇਆ ਮੰਗ ਮੰਗਵਾਉਣ ਵਾਸਤੇ ਕੁਝ ਲੱਭ ਰਿਹਾ ਸੀ ਤਾਂ ਉੱਥੇ ਕੁਝ ਚੀਜ਼ਾਂ ਲੱਭੀਆਂ ਜੋ ਮੇਰੇ ਮੈਂ ਆਪਣੇ ਆਰਡਰ ਵਿੱਚ ਸ਼ਾਮਿਲ ਕਰ ਲਈਆਂ ਜ ਜਿਵੇਂ ਕਿ ਆਲੂ ਦੇ ਪਰਾਂਠੇ ਲੱਸੀ ਦਾ ਗਿਲਾਸ ਮਿਰਚਾਂ ਦਾ ਅਚਾਰ ਜੋ ਜਦੋਂ ਉਸ ਤੋਂ ਬਾਅਦ ਮੈਂ ਆਪਣੇ ਘਰ ਦਾ ਐਡ ਐਡਰੈਸ ਭਰ ਰਿਹਾ ਸੀ ਤਾਂ ਉਸ ਤੋਂ ਭਰਨ ਤੋਂ ਬਾਅਦ ਜਦੋਂ ਮੈਂ ਆਪਣੇ ਪੈਰਾਮੈਂਟ ਦਾ ਭੁਗਤਾਨ ਕਰਨ ਲਈ ਕੋਈ ਅਪ ਆਪਸ਼ਨ ਚੁਣਨਾ ਸੀ ਤਾਂ ਉਸਦੇ ਵਿੱਚ ਮੈਨੂੰ ਕੈਸ ਔਨ ਡਿਲੀਵਰੀ ਸਹੂਲਤ ਨਹੀਂ ਮਿਲੀ ਬਸ ਇਹ ਹੁਣ ਇਹ ਦਿਖਾ ਰਿਹਾ ਸੀ ਕਿ ਔਨਲਾਈਨ ਪੇਮੈਂਟ ਜੋ ਕਿ ਮੈਂ ਨਹੀਂ ਕਰ ਸਕਦਾ ਕਿਉਂਕਿ ਇੱਕ ਤਾਂ ਔਨਲਾਈਨ ਪੇਮੈਂਟ ਚਲਾਉਂਦੇ ਨਹੀਂ ਆ ਨਹੀਂ ਹਾਂ ਅਤੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਆਪਣੀ ਵੈਬਸਾਈਟ 'ਤੇ ਕੈਸ਼ ਹੋਣ ਡਿਲੀਵਰੀ ਦਾ ਆਪਸ਼ਨ ਵੀ ਰੱਖ ਦੇਵੋ ਤਾਂ ਉਹ ਮੇਰੇ ਵਰਗੇ ਕਈ ਹੋਰ ਵੀ ਲੋਕਾਂ ਲਈ ਲਾਭਦਾਇਕ ਹੋਵੇਗਾ ਹੋਵੇਗਾ ਤਾਂ